ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਮੁੱਖ ਸੱਭਿਆਚਾਰ ਹਨ ਜਿਵੇਂ ਕਿ ਪੰਜਾਬ ਦੇ ਲੋਕਾਂ ਦਾ ਖਾਣਾ ਪੀਣਾ ਉਹਨਾਂ ਦਾ ਰਹਿਣ ਸਹਿਣ ਅਤੇ ਹੋਰ ਵੀ ਬਹੁਤ ਉਹਨਾਂ ਦੀ ਸੰਸਕ੍ਰਿਤੀਆਂ ਅਤੇ ਹੋਰ ਵੀ ਬਹੁਤ ਸਾਰੇ ਤਿਉਹਾਰ ਜਿੱਦਾਂ ਕਿ ਵਿਸਾਖੀ ਦੀਵਾਲੀ ਹੋਲੀ ਬਹੁਤ ਹੀ ਜ਼ਿਆਦਾ ਤਿਉਹਾਰ ਹਨ ਪੰਜਾਬ ਦੇ ਪੰਜਾਬੀਆਂ ਦਾ ਤਿਉਹਾਰ ਵਿਸਾਖੀ ਹੈ ਜੋ ਕਿ ਅਪ੍ਰੈਲ ਦੇ ਮਾਘ ਦੇ ਮਹੀਨੇ ਮਨਾਇਆ ਜਾਂਦਾ ਹੈ ਸੱਭਿਆਚਾਰ ਲੋਕ ਸਮੂਹ ਦੁਆਰਾ ਬਣਾਈ ਜੀਵਨ ਦੇ ਇੱਕ ਵਿਸ਼ੇਸ਼ ਜੀਵਨ ਜਾਤ ਦਾ ਨਾਮ ਹੈ ਪਸ਼ੂ ਜੀਵਨ ਤੋਂ ਉੱਪਰ ਉੱਠ ਕੇ ਮਨੁੱਖ ਆਪਣੀਆਂ ਅੰਦਰੂਨੀਆਂ ਕਰਤ ਕਰਾਤੀਆਂ ਸ਼ਕਤੀਆਂ ਨੂੰ ਪ੍ਰਗਟ ਕਰਨਾ ਅਤੇ ਵਿਤ ਆਉਣ ਲਈ ਸੱਭਿਆਚਾਰ ਸਿਰਜਦਾ ਹੈ ਸੱਭਿਆਚਾਰ ਦਾ ਮੁੱਖ ਟੀਚਾ ਮਨ ਸਰੀਰ ਅਤੇ ਆਤਮਾ ਦੀ ਸੰਭਾਵਨਾ ਪੈਦਾ ਕਰਦੇ ਹੋਏ ਮਨੁੱਖ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਸ ਸਮੇਂ ਮਨੁੱਖ ਦੀ ਵਿਅਕਤੀਗਤ ਅਤੇ ਸਮੂਹ ਸੰਭਾਵਨਾ ਨਾਲ ਪਾਲਣ ਪੋਸ਼ਣ ਕਰਨਾ ਹੈ ਖੁਸ਼ੀਆਂ ਭੂ ਭੂਗੋਲਿਕਾ ਖਿੱਤੇ ਦੀਆਂ ਸਰੀਰਕ ਕੁ ਕੁਦਰਤੀਆਂ ਅਤੇ ਜੰਗਲ ਜਲਵਾਯੂ ਦੀਆਂ ਸਿੱਧੀਆਂ ਦੇ ਅਧਾਰ 'ਤੇ ਲੋਕ ਜ਼ਿੰਦਗੀ ਦੇ ਛੋਟੇ ਪਹਿਲੂ ਤੋਂ ਲੈ ਕੇ ਮਹਾਨ ਉਦੇਸ਼ ਤੱਕ ਕਈ ਵਾਰ ਕਈ ਤਰ੍ਹਾਂ ਸੱਭਿਆਚਾਰ ਪ੍ਰਬੰਧਾਂ ਨੂੰ ਨਿਰਮਾਣ ਕਰ ਰਹੇ ਹਨ ਸੱਭਿਆਚਾਰ ਇੱਕ ਗਤੀਸ਼ੀਲ ਵਰਤਾ ਹੈ ਸਰਕਾਰ ਰਾਜਨੀਤਿਕ ਅਤੇ ਹੋਰ ਤਬਦੀਲੀਆਂ ਇਸ ਨੂੰ ਬਦਲਿਆ ਰਹਿੰਦੀਆਂ ਹਨ ਪੰਜਾਬ ਦਾ ਸੱਭਿਆਚਾਰ ਬੋਲੀ ਜਾਣ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਲਿਖਤ ਸਾਹਿਤ ਰਸੋਈ ਵਿਗਿਆਨ ਟੈਕਨੋਲੋਜੀ ਸੈਨਿਕ ਯੁੱਗ ਯੁੱਧ ਰਵਾਇਤਾਂ ਕ ਕਦਰਾਂ ਕੀਮਤਾਂ ਅਤੇ ਪੰਜਾਬ ਲੋਕ ਦੇ ਇਤਿਹਾਸ ਨੂੰ ਸ਼ਾਮਿਲ ਕਰਦਾ ਹੈ ਇਸ ਗਤੀਸ਼ੀਲ ਸਮੇਂ ਵਿੱਚ ਪੰਜਾਬ ਸੱਭਿਆਚਾਰ ਦੇ ਅਸਲ ਸੁਭਾਉ ਦੀ ਪਛਾਣ ਕਰਨ ਦੀ ਲੋੜ ਹੈ ਬਹੁਤ ਵਾਰ ਅਸੀਂ ਅਣਦੇਖੀ ਨੂੰ ਸੱਭਿਆਚਾਰ ਦੀ ਪ੍ਰ ਪ੍ਰਜਨਾਲਤੀ ਬਣਾਉਂਦੇ ਦੀ ਕੋਸ਼ਿਸ਼ ਕਰਦੇ ਹਾਂ